ਸਤਿ ਸ਼੍ਰੀ ਅਕਾਲ ਜੀ ਅਸੀਂ ਮੋਬਾਈਲ ਐਪ ਤੋਂ ਜੋ ਤੁਸੀਂ ਐਡ ਦਿੱਤੀ ਸੀ ਉਹਦੇ ਉੱਤੇ ਸਾਨੂੰ ਕੁਛ ਸ਼ਰਟਾਂ ਫੁੱਲ ਵਾਜੂ ਉਹ ਸਾਨੂੰ ਪਸੰਦ ਆਈਆਂ ਲੇਕਿਨ ਉਹ ਸਕਰੀਨ ਦੇ ਉੱਤੇ ਬਹੁਤ ਹੀ ਵਧੀਆ ਲੱਗ ਰਹੀਆਂ ਸੀ ਮੇਰੇ ਫ੍ਰੈਂਡ ਵੀ ਮੇਰੇ ਨਾਲ ਸੀਗੇ ਅਸੀਂ ਸੋਚਿਆ ਕਿ ਅਸੀਂ ਉਹਨਾਂ ਨੂੰ ਮੰਗਵਾਉਣ ਵਾਸਤੇ ਅਸੀਂ ਓਕੇ ਕੀਤਾ ਅਤੇ ਉਹ ਸਾਡੇ ਕੋਲ ਪਾਰਸਲ ਵੀ ਤਕਰੀਬਨ ਹਫਤੇ ਬਾਅਦ ਆਇਆ ਔਰ ਜਦੋਂ ਅਸੀਂ ਉਹਨਾਂ ਨੂੰ ਪਾਰਸਲ ਨੂੰ ਖੋਲ੍ਹਿਆ ਖੋਲ੍ਹ ਕੇ ਦੇਖਿਆ ਤਾਂ ਉਹਦੇ ਵਿੱਚ ਜੋ ਤੁਸੀਂ ਆਪਣੇ ਸ਼ੋਅ ਦੇ ਵਿੱਚ ਡਿਸਪਲੇਅ ਕੀਤਾ ਸੀ ਉਹ ਸ਼ਰਟਾਂ ਨਹੀਂ ਸਨ ਔਰ ਦੂਸਰੀਆਂ ਕੁਛ ਕੁ ਸ਼ਰਟਾਂ ਬਿਲਕੁਲ ਚਾਰ ਸ਼ਰਟਾਂ ਸੀ ਦੋ ਸ਼ਰਟਾਂ ਬਿਲਕੁਲ ਪੁਰਾਣੀਆਂ ਸੀ ਔਰ ਇੱਕ ਬਿਲਕੁਲ ਖਰਾਬ ਸੀ ਜੋ ਕਿ ਸਾਨੂੰ ਇਹ ਦੇਖ ਕੇ ਐਨਾ ਮਨ ਨੂੰ ਹੋਇਆ ਕਿ ਜੋ ਇਹਨਾਂ ਨੇ ਆਪਣੀ ਉਸ ਦਾ ਐਡਵਟਾਈਸਮੈਂਟ ਕੀਤਾ ਜੋ ਕਿ ਸਾਨੂੰ ਵੀਹ ਪਰਸੈਂਟ ਵੀ ਉਹ ਚੀਜ਼ ਵ ਅੱਛੀ ਨਹੀਂ ਮਿਲੀ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜੋ ਪਾਰਸਲ ਅਸੀਂ ਵਾਪਸ ਕਰ ਰਹੇ ਹਾਂ ਔਰ ਇਸ ਦੇ ਪੈਸੇ ਸਾਨੂੰ ਰੀਫੰਡ ਕੀਤੇ ਜਾਣ ਤਾਂ ਜੋ ਇੱਕ ਜੋ ਆਨਲਾਈਨ ਦਾ ਜ਼ਰੀਆ ਹੈ ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਸਾਨੂੰ ਅੱਛੀ ਚੀਜ਼ ਮਿਲਦੀ ਆ ਲੇਕਿਨ ਇਹ ਬਿਲਕੁਲ ਧੋਖਾ ਹੈ ਲੇਕਿਨ ਸਾਰੀਆਂ ਹੀ ਮਾੜੀਆਂ ਨਹੀਂ ਹਨ ਲੇਕਿਨ ਤੁਸੀਂ ਇੱਕ ਕਲਾਈਂਟ ਦਾ ਜੋ ਕਿ ਇੱਕ ਗਾਹਕ ਹੈ ਉਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਇਹ ਨਹੀਂ ਪਤਾ ਸਾਨੂੰ ਤੁਹਾਡਾ ਸਹੀ ਹੈ ਕਿ ਨਹੀਂ ਹੈ ਲੇਕਿਨ ਸਾਡਾ ਕਿਰਪਾ ਕਰਕੇ ਇਹ ਰੀਫੰਡ ਕੀਤਾ ਜਾਵੇ ਅਤੇ ਪਲੀਜ਼ ਤੁਸੀਂ ਅੱਗੇ ਤੋਂ ਹਮੇਸ਼ਾ ਜੋ ਵੀ ਗਾਹਕ ਸਮਾਨ ਮੰਗਵਾਉਂਦਾ ਹੈ ਉਹਨੂੰ ਸਹੀ ਸਮੇਂ 'ਤੇ ਔਰ ਸਹੀ ਚੌਆਈਸ ਦਾ ਦਿੱਤਾ ਜਾਵੇ ਧੰਨਵਾਦ